ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਚਾਲ ਆ ਵੀਰ ਜੀ ਮੈਂ ਪਲਵਿੰਦਰ ਕੌਰ ਬੋਲਦੀ ਪਈ ਹਾਂਜੀ ਵੀਰ ਜੀ ਮੈਂ ਨਾ ਫੋਨ ਲੈਣਾ ਹਾਂਜੀ ਮੈਂ ਇਸੇ ਲਈ ਤੁਹਾਡੀ ਸਲਾਹ ਲੈਣੀ ਸੀ ਕਿਹੜਾ ਫੋਨ ਲਵਾਂ ਹਾਂਜੀ ਠੀਕ ਠੀਕ ਹੈ ਵੀਰ ਜੀ ਵੀਰ ਜੀ ਮੈਂ ਵੀ ਖਰਚ ਕਰ ਸਕਦੀ ਵੀਹ ਕ ਹਜਾਰ ਤੱਕ ਵੀ ਖਰਚ ਕਰ ਸਕਦੇ ਆ ਉਸ ਹਿਸਾਬ ਤੇ ਆਪਾ ਨੂੰ ਕਿਹੜਾ ਫੋਨ ਮਿਲੇਗਾ ਨਹੀਂ ਆਪਾਂ ਨੂੰ ਕੋਈ ਕੈਮਰਾ ਹਾਂਜੀ ਹਾਂਜੀ ਹਾਂਜੀ ਠੀਕ ਆ ਵੀਵੋ ਹੋ ਜੇ ਤਾਂ ਵਧੀਆ ਹਾਂਜੀ ਇੱਕੀ ਬਾਈ ਹਜ਼ਾਰ ਚਲੋ ਇਨਾ ਕੁ ਤਾਂ ਹੋ ਜਾਵੇ ਤਾਂ ਠੀਕ ਹੈ ਇਸ ਤੋਂ ਇਨਾ ਹੀ ਹੋ ਜਾਵੇ ਵੀ ਇਸ ਤੋਂ ਵੱਧ ਨਾ ਹੋਵੇ

ਠੀਕ ਜੋ ਵੀ ਦਸ ਹਜਾਰ ਬਣ ਜਾਏ ਤੇ ਉਹ ਕੁਆਲਿਟੀ ਵਧੀਆ ਕੈਮਰਾ ਕੁਆਲਟੀ ਬਹੁਤ ਵਧੀਆ ਠੀਕ ਹੈ ਠੀਕ ਠੀਕ ਆਪਾਂ ਬਸ ਇਨਾ ਹੀ ਵੀਹ ਕ ਹਜਾਰ ਤਕ ਪੰਦਰਾ ਵੀਹ ਹਜਾਰ ਤੱਕ ਲੱਗ ਜੇ ਹਾਂਜੀ ਕਿਵੇਂ ਵੀਰ ਜੀ ਓਕੇ ਬਸ ਵੀਰ ਜੀ ਮੈਂ ਕੱਲ ਪਰਸੋਂ ਤੱਕ ਸਾਡੀ ਸ਼ੋਪ ਤੇ ਇੱਕ ਵਾਰੀ ਆਵਾਂਗੇ ਜੀ ਉਸ ਤੋਂ ਬਾਅਦ ਹਾਂਜੀ ਫਿਰ ਆਪਾਂ ਤੁਸੀਂ ਕਰਕੇ ਸਾਨੂੰ ਦੱਸਦੇ ਆ ਮੈਂ ਡਿਸਾਈਡ ਕਰ ਲਾਂਗੀ ਵੀ ਕੀ ਚਾਹੀਦਾ ਠੀਕ ਹੈ ਵੀਰ ਜੀ ਠੀਕ ਠੀਕ ਜੀ

ਠੀਕ ਹੈ ਵੀਰ ਜੀ ਠੀਕ ਠੀਕ ਹੈ ਹੰਜੀ ਮੈਂ ਮੇਰਾ ਤਾਂ ਕੰਮ ਵੀਰ ਜੀ ਵੈਸੇ ਸਲਾਈ ਦਾ ਹੀ ਜਿਆਦਾ

ਹਾਂਜੀ ਹਾਂਜੀ ਤਾਂ ਕਰਕੇ ਹੀ ਜਿਆਦਾ ਕਹਿ ਰਹੇ

ਹਾਂਜੀ ਇਹੀ ਹਾਂਜੀ ਹਾਂਜੀ ਇਹ ਕੈਮਰਾ ਵਧੀਆ ਹੋਵੇ ਕਈ ਵਾਰੀ ਵੀਡੀਓ ਸ਼ੂਟ ਕਰਨੀ ਹੁੰਦੀ ਤਾਂ ਹਾਂਜੀ

ਹਾਂਜੀ ਹਾਂਜੀ ਹਾਂਜੀ ਤੁਸੀਂ ਹਾਂਜੀ ਠੀਕ ਹਾਂਜੀ ਠੀਕ ਠੀਕ ਹੈ ਵੀਰ ਜੀ

ਠੀਕ ਠੀਕ ਹੈ ਵੀਰ ਜੀ ਮਿਹਰਬਾਨੀ ਤੁਹਾਡੀ ਠੀਕ ਹੈ ਧੰਨਵਾਦ ਜੀ